ਸਾਡੇ ਇੱਥੇ ਮਸ਼ਹੂਰ ਸ਼ਿਵ ਸ਼ਕਤੀ ਹੋਟਲ ਹੈ ਜਿੱਥੇ ਮੈਂ ਅਕਸਰ ਖਾਣਾ ਖਾਣ ਜਾਂਦਾ ਹਾਂ ਅਤੇ ਅੱਜ ਮੇਰਾ ਕੁਝ ਨਵਾਂ ਅਤੇ ਵਿਸ਼ੇਸ਼ ਖਾਣ ਨੂੰ ਮਨ ਕੀਤਾ ਜਿਸ ਲਈ ਮੈਂ ਹੋਟਲ ਦੇ ਮਾਲਕ ਨੂੰ ਪੁੱਛਿਆ ਅੱਜ ਇੱਥੇ ਖਾਣੇ ਵਿੱਚ ਖਾਸ ਕੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਅੱਜ ਗੁਜਰਾਤ ਦਾ ਮਸ਼ਹੂਰ ਢੋਕਲਾ ਬਣਾਇਆ ਹੈ ਜੋ ਕਿ ਬਹੁਤ ਹੀ ਸਵਾਦ ਹੈ ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਇਹ ਘਰ ਬੈਠੇ ਕਿਸ ਤਰ੍ਹਾਂ ਲੈ ਸਕਦਾ ਹਾਂ ਤਾਂ ਉਹਨਾਂ ਨੇ ਕਿਹਾ ਸਾਡੀ ਐਪ 'ਤੇ ਜਾ ਕੇ ਉੱਥੋਂ ਔਡਰ ਕਰ ਸਕਦੇ ਹੋ ਅਤੇ ਮੈਂ ਘਰ ਜਾ ਕੇ ਗੂਗਲ 'ਤੇ ਉਹਨਾਂ ਦੀ ਐਪ ਡਾਊਨਲੋਡ ਕੀਤੀ ਅਤੇ ਆਪਣਾ ਢੋਕਲਾ ਆਡਰ ਕੀਤਾ ਔਡਰ ਕਰਨ 'ਤੇ ਕੁਝ ਸਮੇਂ ਬਾਅਦ ਉਹਨਾਂ ਦਾ ਮੁਲਾਜ਼ਮ ਮੇਰਾ ਢੋਕਲਾ ਲੈ ਕੇ ਘਰ ਆ ਗਿਆ ਅਤੇ ਜਦੋਂ ਮੈਂ ਉਹਨਾਂ ਉਹ ਢੋਕਲੇ ਨੂੰ ਖਾਧਾ ਤਾਂ ਮੇਰੇ ਲਈ ਇੱਕ ਨਵਾਂ ਅਤੇ ਵਿਸ਼ੇਸ਼ ਅਨੁਭਵ ਸੀ ਉਹ ਬਹੁਤ ਹੀ ਸਵਾਦਿਸ਼ਟ ਢੋਕਲਾ ਸੀ